ਪੰਜਾਬੀ ਸਾਡੀ ਮਾਂ ਬੋਲੀ ਹੈ ਜੀ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਜੀ ਠੀਕ ਹੈ ਜੀ ਸਾਡੇ ਘਰ ਦੇ ਸਾਰੇ ਪੰਜਾਬੀ ਪੰਜਾਬੀ ਪੜ੍ਹ ਲੈਂਦੇ ਹਨ ਲਿਖ ਲੈਂਦੇ ਹਨ ਬੋਲ ਲੈਂਦੇ ਹਨ ਠੀਕ ਆ ਜੀ ਮੈਂ ਪੰਜਾਬ ਵਿੱਚ ਰਹਿੰਦਾ ਹਾਂ ਜੀ ਮੈਂ ਵੀ ਪੰਜਾਬੀ ਪੜ੍ਹਦਾ ਹੈਗਾ ਜੀ ਲਿਖਦਾ ਹਾਂ ਜੀ ਬੋਲਦਾ ਹਾਂ ਜੀ ਠੀਕ ਆ ਜੀ ਸਾਡੇ ਸਕੂਲ ਵਿੱਚ ਜ਼ਿਆਦਾਤਰ ਪੰਜਾਬੀ ਪੜ੍ਹਾਈ ਜਾਂਦੀ ਹੈ ਜੀ ਸਿੱਖਿਆ ਬੋਰਡ ਵੱਲੋਂ ਜਿਵੇਂ ਸਾਨੂੰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੀਆਂ ਬੁੱਕਾਂ ਸਾਰੀਆਂ ਫਰੀ ਮਿਲਦੀਆਂ ਹਨ ਠੀਕ ਆ ਜੀ ਅੱਜ ਦੇ ਸਮੇਂ ਵਿੱਚ ਲੋਕ ਜ਼ਿਆਦਾਤਰ ਇੰਗਲਿਸ਼ ਇੰਗਲਿਸ਼ ਪੜ੍ਹਦੇ ਹਨ ਬਾਹਰ ਜਾਣ ਦੇ ਚੱਕਰ ਵਿੱਚ ਲੋਕ ਇੰਗਲਿਸ਼ ਜ਼ਿਆਦਾ ਪੜ੍ਹਦੇ ਹਨ ਆਪਣੀ ਮਾਂ ਬੋਲੀ ਨੂੰ ਛੱਡਦੇ ਜਾ ਰਹੇ ਹਨ ਠੀਕ ਹੈ ਜੀ ਇਸ ਲਈ ਸਾਨੂੰ ਸਕੂਲਾਂ ਵਿੱਚ ਜ਼ਿਆਦਾਤਰ ਪੰਜਾਬੀ ਪੜ੍ਹਾਈ ਜਾਂਦੀ ਹੈ ਜੀ ਠੀਕ ਹੈ ਜੀ ਤਾਂ ਇਸ ਲਈ ਸਾਨੂੰ ਆਪਣੀ ਮਾਂ ਬੋਲੀ ਕਦੇ ਛੱਡਣੀ ਨਹੀਂ ਚਾਹੀਦੀ ਠੀਕ ਹੈ ਜੀ ਸਾਨੂੰ ਪੰਜਾਬੀ ਬੋਲਣੀ ਬਹੁਤ ਪਸੰਦ ਹੈ ਜੀ ਇਹ ਸਾਡੀ ਭਾਰਤ ਦੀ ਪ੍ਰਸਿੱਧ ਬੋਲੀ ਹੈ ਜੀ ਮਾਂ ਬੋਲੀ ਹੈ